ਪੰਜਾਬ ਵਿੱਚ ਕਾਰੋਬਾਰ ਦੀ ਗੱਲ ਕਰਾਂ ਤਾਂ ਕਾਰੋਬਾਰ ਬਿਲਕੁਲ ਠੱਪ ਹੋ ਗਏ ਹਨ ਪੜ੍ਹੇ ਲਿਖੇ ਨੌਜਵਾਨ ਆਪਣੀ ਮਾਂ ਧਰਤੀ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ਕਿਉਂਕਿ ਪੰਜਾਬ ਵਿੱਚ ਕੋਈ ਜ਼ਿਆਦਾ ਕੰਮਕਾਰ ਰਿਹਾ ਨਹੀਂ ਹੈ ਲੋਕਾਂ ਨੂੰ ਨੌਕਰੀ ਮਿਲ ਨਹੀਂ ਰਹੀ ਨੌਕਰੀ ਇਸ ਕਰਕੇ ਨਹੀਂ ਮਿਲ ਰਹੀ ਕਿਉਂਕਿ ਅੱਜ ਕੱਲ੍ਹ ਜੇ ਸਰਕਾਰੀ ਨੌਕਰੀ ਵੀ ਨਿਕਲਦੀ ਹੈ ਤਾਂ ਕਿਆ ਹੈ ਕਿ ਉਹਦੇ ਵਿੱਚ ਰਿਸ਼ਵਤਖੋਰ ਬੰਦੇ ਬੈਠੇ ਹਨ ਜਿਹਨਾਂ ਦੀ ਜਾਣ ਪਛਾਣ ਬਣੀ ਹੋਈ ਹੈ ਅਫਸਰਾਂ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕਰਾ ਲੈਂਦੇ ਹਨ ਅਤੇ ਜਿਹੜਾ ਦੂਸਰਾ ਬੰਦਾ ਹੈ ਉਹ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਜੇ ਗੱਲ ਕਰਾਂ ਤਾਂ ਜੇ ਬੰਦਾ ਕੋਈ ਆਪਣਾ ਕੰਮ ਕਰਨ ਬਾਰੇ ਸੋਚੇ ਤਾਂ ਕੰਪੀਟੀਸ਼ਨ ਦਾ ਦੌਰ ਇੰਨਾ ਚੱਲ ਚੁੱਕਿਆ ਹੈ ਕਿ ਜਿਵੇਂ ਅੱਜ ਕਿਸੇ ਨੇ ਕੋਈ ਖਾਣ ਪੀਣ ਦੀ ਦੁਕਾਨ ਖੋਲ੍ਹੀ ਤਾਂ ਉਹਦੇ ਨਾਲ ਬਿਲਕੁਲ ਸਾਹਮਣੇ ਹੀ ਇੱਕ ਬੰਦਾ ਦੂਸਰੀ ਦੁਕਾਨ ਖੋਲ੍ਹ ਲੈਂਦਾ ਹੈ ਜਿਸ ਕਰਕੇ ਅਗਲੇ ਦਾ ਕੰਮ ਵੀ ਰੁਕ ਜਾਂਦਾ ਹੈ ਅਤੇ ਬੰਦਾ ਸੋਚਦਾ ਹੈ ਕਿ ਹੁਣ ਇਸ ਤੋਂ ਇਲਾਵਾ ਬੰਦਾ ਕਿਆ ਕਰੇ ਅਤੇ ਇਸ ਚੱਕਰ ਕਰਕੇ ਜਿਵੇਂ ਕਾਰੋਬਾਰ ਨਹੀਂ ਹੈ ਤਾਂ ਲੋਕ ਨਸ਼ੇ ਵੱਲ ਜ਼ਿਆਦਾ ਜਾ ਰਹੇ ਹਨ